ਹਾਂ ਮੈਂ ਕਈ ਵਾਰ ਮਾਈਗ੍ਰੇਸ਼ਨ ਕਰਦੇ ਹੋਏ ਪੰਛੀ ਵੇਖੇ ਹਨ ਇਹ ਹਨ ਸਾਈਬੇਰੀਅਨ ਕਰੇਨ ਰੋਜੀ ਪੈਲੀਕਨ ਗ੍ਰੇਟਰ ਫਲੈਮਿੰਗੋ ਬਲੂਥੋਰਡ ਅਤੇ ਰਫ ਇਹ ਯੂਰਪ ਅਤੇ ਅਲਾਸਕਾ ਦੇ ਠੰਡੇ ਇਲਾਕਿਆਂ ਵਿੱਚੋਂ ਹਿੰਦੁਸਤਾਨ ਵਿੱਚ ਆਉਂਦੇ ਹਨ ਅਤੇ ਜ਼ਿਆਦਾਤਰ ਰਾਜਸਥਾਨ ਦੇ ਇਲਾਕਿਆਂ ਵਿੱਚ ਦੇਖੇ ਜਾਂਦੇ ਹਨ